ਵੈਸੇ ਤਾਂ ਮੈਨੂੰ ਸਿਲਾਈ ਬੁਣਾਈ ਕਰਨਾ ਅੱਛਾ ਲੱਗਦਾ ਹੈ ਅਤੇ ਮੈਂ ਜਿਹੜੀ ਸਿਲਾਈ ਕਰਨੀ ਉਹ ਇੱਕ ਸਟਿਚਿੰਗ ਇੰਸਟੀਚਿਊਟ ਤੋਂ ਸਿੱਖੀ ਹੋਈ ਆ ਅਤੇ ਮੇਰਾ ਅੱਜ ਤੱਕ ਦਾ ਸਭ ਤੋਂ ਚੁਣੌਤੀਪੂਰਨ ਜਿਹੜਾ ਕੱਪੜਾ ਰਿਹਾ ਸੀ ਉਹਦੀ ਮੈਂ ਕਹਾਣੀ ਸਾਂਝੀ ਕਰ ਰਹੀ ਹਾਂ ਤੁਹਾਡੇ ਨਾਲ ਅਤੇ ਉਹ ਸੀ ਮੈਂ ਇੱਕ ਸਹੇਲੀ ਦੀ ਪਾਰਟੀ 'ਤੇ ਫੰਕਸ਼ ਪ੍ਰੋਗਰਾਮ ਸੀ ਅਤੇ ਉਦੋਂ ਮੈਂ ਸਟਿੱਚ ਕਰਨਾ ਸੀ ਆਪ ਹੀ ਅਤੇ ਉਹਦਾ ਮਟੀਰੀਅਲ ਤਾਂ ਮੈਨੂੰ ਬਾਜ਼ਾਰੋਂ ਅਸਾਨੀ ਨਾਲ ਮਿਲ ਗਿਆ ਪਰ ਮੈਂ ਜਦੋਂ ਉਹਨੂੰ ਸਟੀਚਿੰਗ ਕਰਨ ਲੱਗੀ ਤਾਂ ਮੇਰੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਆਈਆਂ ਉਹਦੇ ਉੱਤੇ ਕੱਪੜੇ ਉੱਤੇ ਮੋਤੀਆਂ ਸਿੱਪੀਆ ਸਿਤਾਰੇ ਹੋਣ ਕਰਕੇ ਪਹਿਲਾਂ ਤਾਂ ਉਹਦੀ ਕਟਿੰਗ ਬੜੀ ਮੁਸ਼ਕਿਲ ਹੋਈ ਅਤੇ ਫਿਰ ਜਦੋਂ ਮੈਂ ਉਹਨੂੰ ਸੀਣ ਲੱਗੀ ਮਸ਼ੀਨ ਦੇ ਵਿੱਚ ਤਾਂ ਉਹਦੀ ਜਿਹੜੀ ਸੂਈ ਵੀ ਸਹੀ ਨਹੀਂ ਸੀ ਚੱਲਦੀ ਮੋਤੀਆਂ ਕਰਕੇ ਅਤੇ ਉਹਦੀਆਂ ਚੋਣਾਂ ਵੀ ਸਹੀ ਨਹੀਂ ਸੀ ਪੈ ਰਹੀਆਂ ਅਤੇ ਇਸ ਦੇ ਮੁਤਾਬਿਕ ਸਭ ਤੋਂ ਲਾਭਦਾਇਕ ਕੱਪੜਾ ਹੈਗਾ ਇੱਕ ਸਿੰਪਲ ਸੂਟ ਸਲਵਾਰ ਸੀਣਾ ਜੋ ਕਿ ਸਮਾਂ ਵੀ ਘੱਟ ਲੈਂਦਾ ਹੈ ਅਤੇ ਸੀ ਵੀ ਜਲਦੀ ਜਾਂਦਾ ਅਤੇ ਅੱਜ ਤੱਕ ਜੋ ਮੈਂ ਬੁਣਿਆ ਉਹ ਸੀ ਸਰਦੀਆਂ ਵਾਸਤੇ ਮੈਂ ਜੁਰਾਬਾਂ ਬੁਣੀਆਂ ਸੀ ਅਤੇ ਵੈਸੇ ਤਾਂ ਬੁਣਾਈ ਇੰਨੀ ਔਖੀ ਨਹੀਂ ਹੈ ਕਿਉਂਕਿ ਮੈਂ ਉਹ ਵੀ ਸਿੱਖੀ ਹੋਈ ਹੈ ਪਰ ਜਦੋਂ ਮੈਂ ਜੁਰਾਬਾਂ ਬਣਾਈਆਂ ਤਾਂ ਸਾਰੀਆਂ ਜੁਰਾਬਾਂ ਮੇਰੇ ਕੋਲ ਅਸਾਨੀ ਨਾਲ ਬਣ ਗਈਆਂ ਉਹਦਾ ਜਦੋਂ ਪੰਜਾ ਅਤੇ ਅੰਗੂਠਾ ਅਲੱਗ ਕਰੀਦਾ ਤਾਂ ਉਹ ਦੇ ਵਿੱਚ ਮੈਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਅਤੇ ਬੁਣਾਈ ਦੇ ਵਿੱਚ ਸਭ ਤੋਂ ਔਖਾ ਹਿੱਸਾ ਉਹ ਹੀ ਰਿਹਾ ਸੀ